ਪੰਜਾਬ ਵਿੱਚ ਪੰਜਾਬੀ ਭਾਸ਼ਾ ਹੀ ਬੋਲੀ ਜਾਂਦੀ ਹੈ ਜ਼ਿਆਦਾ ਅਤੇ ਪੰਜਾਬੀ ਲਿਖੀ ਜਾਂਦੀ ਹੈ ਜ਼ਿਆਦਾਤਰ ਭਾਸ਼ਾ ਨੂੰ ਸੰਭਾਲਣ ਦਾ ਸੱਭਿਆਚਾਰ ਵਿਰਾਸਤ ਨੂੰ ਸੰਭਾਲਣ ਦਾ ਸਰਕਾਰਾਂ ਦਾ ਅਤੇ ਉੱਚੇ ਵਿਗਿਆਨੀਆਂ ਦਾ ਉੱਚੇ ਡਾਕਟਰਾਂ ਦਾ ਉੱਚੇ ਸਾਹਿਤਕ ਬੰਦਿਆਂ ਦਾ ਮਨੁੱਖ ਦਾ ਹੀ ਜ਼ਿਆਦਾ ਯੋਗਦਾਨ ਹੁੰਦਾ ਅਤੇ ਇਹਦੇ 'ਚ ਆਮ ਜਨਤਾ ਦਾ ਵੀ ਯੋਗਦਾਨ ਹੁੰਦਾ ਜਿਵੇਂ ਮੰਨ ਲਓ ਕੋਈ ਬੱਚਾ ਗਾ ਜੇ ਆਪਾਂ ਉਹਨੂੰ ਪੰਜਾਬੀ ਨਾ ਕਹਾਂਗੇ ਵੀ ਨਹੀਂ ਇਹ ਨਹੀਂ ਸਿੱਖਣੀ ਤੂੰ ਇੰਗਲਿਸ਼ ਸਿੱਖਣੀ ਹੈ ਅੰਗਰੇਜ਼ੀ ਸਿੱਖਣੀ ਹੈ ਅਤੇ ਉਹ ਫਿਰ ਬੱਚਾ ਕਿਵੇਂ ਸਿੱਖ ਪਾਊਗਾ ਆਪਾਂ ਨੂੰ ਵੀ ਜ ਕਰਨਾ ਚਾਹੀਦਾ ਜੇ ਮੇਨ ਸਰਕਾਰਾਂ ਨੂੰ ਵੀ ਇਹਦੇ 'ਚ ਵੱਧ ਤੋਂ ਵੱਧ ਇਹਦੇ ਗਿਆਨ ਵੰਡਣਾ ਚਾਹੀਦਾ ਕਿ ਪੰਜਾਬੀ ਨੂੰ ਅੱਗੇ ਲੈ ਕੇ ਆਓ ਹਾਂ ਕੋਈ ਭਾਸ਼ਾ ਮਾੜੀ ਨਹੀਂ ਸਿੱਖੋ ਸਾਰੀਆਂ ਸਿੱਖੋ ਪਰ ਪੰਜਾਬੀ ਨੂੰ ਅਹਿਮੀਅਤ ਜ਼ਿਆਦਾ ਦਿਓ ਕਿਉਂਕਿ ਆਪਣੀ ਮਾਂ ਬੋਲੀ ਹੈ ਇਸ ਤਰ੍ਹਾਂ ਹੀ ਆਪਾਂ ਅੱਗੇ ਇਹਨੂੰ ਵਧਾ ਸਕਦੇ ਹਾਂ